ਟੈਕਨੋ ਟੈਕਨੋਲੋਜੀ ਨੇ ਆਵਾਜਾਈ ਦੇ ਉਦਯੋਗ ਵਿੱਚ ਕਾਫ਼ੀ ਮਦਦ ਕੀਤੀ ਹੈ ਟੈਕਨੋਲੋਜੀ ਰਾਹੀਂ ਅਸੀਂ ਅੱਜ ਕੱਲ੍ਹ ਕਿਸੇ ਵੀ ਬੱਸ ਅਤੇ ਟ੍ਰੇਨ ਦਾ ਪਤਾ ਜਾਣ ਸਕਦੇ ਹਾਂ ਸਾਨੂੰ ਇੰਟਰਨੈੱਟ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਬੱਸ ਕਿੰਨੇ ਵਜੇ ਕਿਹੜੇ ਬੱਸ ਸਟੈਂਡ 'ਤੇ ਹੋਵੇਗੀ ਅਤੇ ਕਿਹੜੀ ਟ੍ਰੇਨ ਕਿੰਨੇ ਵਜੇ ਕਿਹੜੇ ਸਟੇਸ਼ਨ 'ਤੇ ਹੋਵੇਗੀ ਇੱਥੋਂ ਤੱਕ ਕਿ ਓਲਾ ਅਤੇ ਊਬਰ ਵਰਗੀਆਂ ਐਪਾਂ ਸਾਨੂੰ ਘਰੋਂ ਹੀ ਟੈਕਸੀ ਬੁੱਕ ਕਰਵਾਉਣ ਵਿੱਚ ਮਦਦ ਕਰਦੀਆਂ ਹਨ ਅਸੀਂ ਘਰ ਬੈਠੇ ਬੈਠੇ ਹੀ ਟੈਕਸੀ ਬੁੱਕ ਕਰਾ ਸਕਦੇ ਹਾਂ ਜੋ ਕਿ ਸਾਡੇ ਘਰ ਦੇ ਗੇਟ 'ਤੇ ਹੀ ਆ ਜਾਂਦੀ ਹੈ ਸਾਨੂੰ ਲੈਣ ਵਾਸਤੇ ਜੇਕਰ ਅਸੀਂ ਕੋਈ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਨੀਆਂ ਹਨ ਉਹ ਵੀ ਐਪ ਰਾਹੀਂ ਹੋ ਸਕਦੀਆਂ ਹਨ ਇਸ ਵਾਸਤੇ ਵੀ ਰੇਲਵੇ ਵਾਲਿਆਂ ਨੇ ਆਪਣਾ ਐਪ ਚਲਾਇਆ ਹੈ ਨਹੀਂ ਤਾਂ ਅਸੀਂ ਉਹਨਾਂ ਦੇ ਵੈਬਸਾਈਟ ਉੱਤੇ ਜਾ ਕੇ ਵੀ ਬੁੱਕ ਕਰ ਸਕਦੇ ਹਾਂ ਇਹ ਵੀ ਉਸ ਐਪ ਤੋਂ ਅਸੀਂ ਉਹ ਰੇਲ ਗੱਡੀਆਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ ਕਿ ਉਹ ਇਸ ਟਾਈਮ ਕਿੱਥੇ ਪਹੁੰਚੀਆਂ ਹਨ ਅਤੇ ਸਾਡੇ ਸਟੇਸ਼ਨ 'ਤੇ ਉਹ ਕਦੋਂ ਆਉਣਗੀਆਂ ਗੱਡੀਆਂ ਵਿੱਚ ਵੀ ਅੱਜ ਕੱਲ੍ਹ ਫਾਸਟ ਟੈਗ ਲੱਗ ਚੁੱਕੇ ਹਨ ਜੋ ਕਿ ਸਾਨੂੰ ਮਦਦ ਕਰਦੇ ਹਨ ਤਾਂ ਜੋ ਅਸੀਂ ਟੋਲ ਪਲਾਜ਼ਾ ਉੱਤੇ ਜ਼ਿਆਦਾ ਟਾਈਮ ਨਾ ਲਾਈਏ ਅਤੇ ਸਾਨੂੰ ਰੁਕਣਾ ਨਾ ਪਵੇ ਸ ਲੰਘਦੇ ਲੰਘਦੇ ਹੀ ਸਾਡੇ ਪੈਸੇ ਆਪੇ ਸਾਡੇ ਬੈਂਕ 'ਚੋਂ ਕੱਟੇ ਜਾਂਦੇ ਹਨ ਜੋ ਕਿ ਟੋਲ ਟੈਕਸ ਵਾਲਿਆਂ ਨੂੰ ਮਿਲ ਜਾਂਦੇ ਹਨ ਫ ਔਨਲਾਈਨ ਆਪਣਾ ਡਰਾਈਵਿੰਗ ਲਾਈਸੈਂਸ ਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ ਉਹ ਵੀ ਬਹੁਤ ਆਸਾਨੀ ਨਾਲ਼ ਅਤੇ ਜੇਕਰ ਸਾਡੇ ਕੋਲ ਕਿਸੇ ਵੀ ਗੱਡੀ ਦੇ ਕਾਗਜ਼ਾਂ ਦੀ ਘਾਟ ਹੈ ਉਹ ਵੀ ਅਸੀਂ ਔਨਲਾਈਨ ਅਪਲਾਈ ਕਰ ਸਕਦੇ ਹਾਂ ਤਾਂ ਜੋ ਸਾਨੂੰ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣ